ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮ ਚਲਾਏ ਹੋਏ ਹਨ ਜਿਹਨਾਂ ਦਾ ਉਦੇਸ਼ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਲਾਭ ਦੇਣਾ ਹੈ ਪੰਜਾਬ ਦੇ ਖੇਤਰ ਵਿੱਚ ਸਰਕਾਰਾਂ ਨੇ ਬਜ਼ੁਰਗਾਂ ਅਤੇ ਵਿਕਲਾਂਗ ਲੋਕਾਂ ਲਈ ਸਫਰ ਵਿੱਚ ਛੌਟ ਅਤੇ ਪੈਨਸ਼ਨਾਂ ਦੀ ਸਹੂਲਤ ਦਿੱਤੀ ਹੋਈ ਹੈ ਇਸ ਖੇਤਰ ਵਿੱਚ ਹੋਰ ਵੀ ਭਲਾਈ ਸਕੀਮਾਂ ਹਨ ਜਿਵੇਂ ਕੰਨਿਆ ਸਕੀਮ ਰਾਸ਼ਨ ਕਾਰਡ ਵਾਲੀ ਸਕੀਮ ਜਿਸ ਨਾਲ ਮੁਫਤ ਅਨਾਜ ਦਿੱਤਾ ਜਾਂਦਾ ਹੈ ਇਲਾਜ ਦੇ ਲਈ ਆਯੂਸ਼ਮਾਨ ਕਾਰਡ ਬਣੇ ਹੋਏ ਹਨ ਜਿਸ ਵਿੱਚ ਪੰਜ ਲੱਖ ਤੱਕ ਫਰੀ ਇਲਾਜ ਕਰਾ ਸਕਦੇ ਹੈ ਰੁਜ਼ਗਾਰ ਦੇ ਵਿੱਚ ਸਰਕਾਰਾਂ ਨੇ ਰੁਜ਼ਗਾਰ ਦੇਣ ਲਈ ਰੁਜ਼ਗਾਰ ਮੇਲੇ ਅਤੇ ਰੋ ਬੇਰੁਜ਼ਗਾਰੀ ਲਈ ਬੇਰੁਜ਼ਗਾਰੀ ਭੱਤਾ ਲਾਇਆ ਹੋਇਆ ਹੈ ਸਿੱਖਿਆ ਦੇ ਵਿੱਚ ਸਰਕਾਰਾਂ ਨੇ ਸਕੂਲਾਂ ਵਿੱਚ ਉਚੇਰੀ ਵਿੱਦਿਆ ਲਈ ਚੰਗੇ ਅਧਿਆਪਕ ਅਤੇ ਹਰ ਤਰ੍ਹਾਂ ਦੀ ਟੈਕਨੋਲਜੀ ਦੀ ਸਹੂਲਤਾਂ ਦਿੱਤੀਆਂ ਹੋਈਆਂ ਹਨ ਅਤੇ ਸਿਹਤ ਸੰਭਾਲ ਵਧੀਆ ਹਸਪਤਾਲ ਬਣਾਏ ਗਏ ਹਨ ਜਿਹਨਾਂ ਵਿੱਚ ਹਰ ਤਰ੍ਹਾਂ ਦਾ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਹਨ ਇਸ ਸਾਰੇ ਪੜਾਵਾਂ ਵਿੱਚ ਦਿੱਤੀਆਂ ਸਹੂਲਤਾਂ ਦਾ ਮੰਤਵ ਲੋਕਾਂ ਨੂੰ ਲਾਭ ਪਹੁੰਚਾਉਣਾ ਹੀ ਹੈ